ਬਦਲਦੇ ਮੌਸਮ ਦਾ ਕਿਸਾਨਾਂ ਨੇ ਇਸ ਰੁਕਾਵਟ ਜਿਹੜਾ ਨੁਕਸਾਨ ਹੋਇਆ ਉਸਦੀ ਭਰਭਾਈ ਕਰਨੇ ਲਈ ਦੁਬਾਰਾ ਮਿਹਨਤ ਕਰਨੀ ਪਈ ਕਿਉਂਕਿ ਜਿਹੜੀ ਫਸਲ ਪਹਿਲਾਂ ਬੀਜੀ ਹੋਈ ਸੀ ਉਹ ਮੀਂਹ ਪਾਣੀ ਦੇ ਆਉਣ ਕਰਕੇ ਹੜਾਂ ਦੇ ਪਾਣੀ ਨਾਲ਼ ਖਰਾਬ ਹੋ ਗਈ ਅਤੇ ਰੇਤਾ ਭਰ ਚੁੱਕਾ ਸੀ ਕਾਫੀ ਰੇਤੇ ਨੂੰ ਹਟਾਉਣ ਲਈ ਟਰੈਕਟਰ ਟਰਾਲੀਆਂ ਟਰੈਕਟਾਂ ਨਾਲ਼ ਕਰਾਹ ਨਾਲ ਕਾਫੀ ਮਿਹਨਤ ਕਰਨੀ ਪਈ ਉਹਨੂੰ ਸਭ ਪਾਸੇ ਕਰਕੇ ਸਭ ਨੂੰ ਫਿਰ ਦੁਬਾਰਾ ਤੋਂ ਫਸਲ ਬੀਜਣ ਲਈ ਬੜੀ ਹੀ ਮਿਹਨਤ ਲਗਨ ਨਾਲ਼ ਕਰਨੀ ਪਈ